ਨਿੱਜੀ ਇੱਛਾ ਗਰੀਬ ਵਰਗ ਦੇ ਨਾਲ ਹੈ ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਹਿੱਸਾ ਗਰੀਬ ਵਰਗ ਦਾ ਹੈ ਉਹਨਾਂ ਨੂੰ ਦਿਨ ਵਿੱਚ ਦੋ ਡੰਗ ਦੀ ਰੋਟੀ ਵੀ ਬੜੀ ਮੁਸ਼ਕਿਲ ਨਾਲ ਪ੍ਰਾਪਤ ਹੁੰਦੀ ਹੈ ਗਰੀਬ ਵਰਗ ਪੈਸੇ ਦੀ ਕਮੀ ਕਾਰਨ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ ਮੈਂ ਗਰੀਬ ਵਰਗ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਉਹਨਾਂ ਦੀ ਬਸਤੀ ਵਿੱਚ ਜਾ ਕੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਦੀ ਇੱਛਾ ਜਾਹਰ ਕੀਤੀ ਮੈਂ ਗਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਕਿਰਾਏ ਦਾ ਇੱਕ ਕਮਰਾ ਲਿੱਤਾ ਅਤੇ ਜਦੋਂ ਮੈਂ ਉਹਨਾਂ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਬੱਚਿਆਂ ਦਾ ਦਿਮਾਗ ਦੇਖ ਕੇ ਖੁਦ ਹੈਰਾਨ ਹੋ ਗਈ ਕਿ ਬ ਕਿ ਗਰੀਬੀ ਕਾਰਨ ਇਹ ਬੱਚੇ ਪੜ੍ਹਨ ਤੋਂ ਰਹਿ ਜਾਂਦੇ ਹਨ ਜਦੋਂ ਕਿ ਇਹ ਗਰੀਬ ਬੱਚੇ ਪੜ੍ਹ ਲਿਖ ਕੇ ਦੇਸ਼ ਦੇ ਨਾਂ ਨੂੰ ਰੋਸ਼ਨ ਕਰ ਸਕਦੇ ਹਨ ਇਹਨਾਂ ਵਿੱਚੋਂ ਕੋਈ ਡਾਕਟਰ ਇੰਜੀਨੀਅਰ ਅਤੇ ਕਈ ਹੋਰ ਉੱਚੇ ਪੱਧਰ 'ਤੇ ਜਾ ਸਕਦੇ ਹਨ ਮੇਰੀ ਨਿਜੀ ਇੱਛਾ ਹੈ ਕਿ ਗਰੀਬ ਵਰਗ ਨੂੰ ਪੜ੍ਹਾਈ ਦੀ ਸਹੂਲਤ ਦਿੱਤੀ ਜਾਵੇ ਅਤੇ ਸਕੂਲਾਂ ਵਿੱਚ ਉਹਨਾਂ ਨੂੰ ਮੁਫ਼ਤ ਕਿਤਾਬਾਂ ਕਾਪੀਆਂ ਵਰਦੀ ਵੀ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਪੜ੍ਹਾਈ ਸ਼ੁਰੂ ਕਰ ਸਕਣ ਅਤੇ ਦੇਸ਼ ਦੇ ਨਾਮ ਨੂੰ ਉੱਚਾ ਕਰ ਸਕਣ